ਪੰਜਾਬ ਵਿੱਚ ਹਰ ਤਰ੍ਹਾਂ ਦੇ ਧਰਮਾਂ ਅਤੇ ਜਾਤਾਂ ਦੇ ਲੋਕ ਪਾਏ ਜਾਂਦੇ ਹਨ ਪੰਜਾਬ ਵਿੱਚ ਗੁਰਦੁਆਰਾ ਮੰਦਰ ਮਸਜਿਦ ਹਰ ਥਾਂ 'ਤੇ ਹਰ ਹਰ ਤਿਥੀ ਤਿਉਹਾਰ 'ਤੇ ਲੰਗਰ ਲਗਾਏ ਜਾਂਦੇ ਹਨ ਇੱਥੇ ਸਮਾਜ ਸੇਵਿਕਾ ਵੀ ਹਨ ਜੋ ਕਿ ਹਰ ਲੋੜਵੰਦ ਦੀ ਚਾਹੇ ਉਹ ਖਾਣ ਪੀਣ 'ਚ ਹੋਵੇ ਚਾਹੇ ਉਹ ਦਵਾਈ 'ਚ ਹੋਵੇ ਚਾਹੇ ਕਿਸੀ ਤਰ ਕਿਸੇ ਵੀ ਤਰੀਕੇ ਦੀ ਅਗਰ ਉਹਨਾਂ ਨੂੰ ਲੋੜਵੰਦ ਹੋਵੇ ਤਾਂ ਅੱਗੇ ਵੱਧ ਕੇ ਉਹਨਾਂ ਦੀ ਲੋੜ ਸਹਾਇਤਾ ਕਰਦੇ ਹਨ ਅਤੇ ਕੋਈ ਵੀ ਉਰੇ ਭੁੱਖਾ ਨਹੀਂ ਸੌਂਦਾ ਚਾਹੇ ਉਹ ਗੁਰਦੁਆਰੇ ਚਲੇ ਜਾਵੇ ਚਾਹੇ ਉਹ ਮੰਦਰ ਚਲ ਜਾਵੇ ਹਰ ਕੋਈ ਭੁੱਖੇ ਨੂੰ ਅੰਨ ਦਿੰਦਾ ਹੈ ਅਤੇ ਪਾਣੀ ਦਿੰਦਾ ਹੈ